ਏ ਟੀ ਆਈ ਰੋਡ ਇਟਾ ਵਾਲਾ ਚੌਂਕ ਪ੍ਰਤਾਪ ਚੌਂਕ ਢੋਲੇਵਾਲ ਚੌਂਕ ਸ਼ੇਰਪੁਰ ਚੌਂਕ ਬੀ ਆਰ ਐਸ ਨਗਰ ਜਮਾਲਪੁਰ ਜੋਧੇਆਲ ਬਸਤੀ